ਹੈਲੋ ਹਾਂਜੀ ਸਰ ਕੌਣ ਬੋਲ ਰਹੇ ਹੋ ਅੱਛਾ ਅੱਛਾ ਸਰ ਅੱਛਾ ਠੀਕ ਹੈ ਸਰ ਹਾਂਜੀ ਸਰ ਕਾਰ ਇੰਸ਼ੋਰੈਂਸ ਬਾਰੇ ਸੀਗਾ ਹਾਂਜੀ ਸਰ ਮੇਰੀ ਕਾਰ ਦੀ ਇੰਸ਼ੋਰੈਂਸ ਖ਼ਤਮ ਹੋਣ ਵਾਲਾ ਸਰ ਦੋ ਤਿੰਨ ਦਿਨਾਂ ਤੱਕ ਸਰ ਦੋ ਤਿੰਨ ਤੱਕ ਮਤਲਬ ਸਤਾਰਾਂ ਤਾਰੀਕ ਤੱਕ ਹੋ ਜੇਗਾ ਸਰ ਖ਼ਤਮ ਹਾਂਜੀ ਸਰ ਠੀਕ ਹੈ ਸਰ ਥ੍ਰੀ ਫੋਰ ਸਿਕਸ ਨਾਈਨ ਫੋਰ ਫਾਈਵ ਏਟ ਵੰਨ ਹਾਂਜੀ ਸਰ ਮਾਰੂਤੀ ਮਾਡਲ ਹੈ ਗੱਡੀ ਦਾ ਸਰ ਗੀਤਾ ਰਾਣੀ ਨਾਮ ਤੋਂ ਹੋਵੇਗਾ ਸਰ ਆਧਾਰ ਕਾਰਡ ਦੇ ਤਿੰਨ ਡੀਜਿਟ ਫੋਰ ਸਿਕਸ ਸੈਵਨ ਥ੍ਰੀ ਜ਼ੀਰੋ ਵੰਨ ਹਾਂਜੀ ਸਰ ਹਾਂਜੀ ਸਰ ਪਿਛਲੇ ਮਹੀਨੇ ਸਰ ਸਾਡੀ ਗੱਡੀ ਦਾ ਐਕਸੀਡੈਂਟ ਵੀ ਹੋਇਆ ਸੀਗਾ ਅਤੇ ਉਦੋਂ ਸਰ ਇੰਸ਼ੋਰੈਂਸ ਕਲੇਮ ਵੀ ਕਰਵਾਇਆ ਸੀ ਸਰ ਹਾਂਜੀ ਸਰ ਉਦੋਂ ਸਾਡਾ ਵੀਹ ਕੁ ਹਜ਼ਾਰ ਦਾ ਖਰਚਾ ਆਇਆ ਸੀਗਾ ਹੁਣ ਦੱਸ ਦਿਓ ਕੀ ਹਿਸਾਬ ਕਿਤਾਬ ਹੋਣਾ ਸਰ ਹਾਂਜੀ ਅੱਛਾ ਸਰ ਹਾਂਜੀ ਅੱਛਾ ਸਰ ਠੀਕ ਹੈ ਸਰ ਸਤਾਰਾਂ ਤਰੀਕ ਤੋਂ ਬਾਅਦ ਫਿਰ ਹੋਰ ਹਾਂਜੀ ਹਾਂਜੀ ਸਰ ਹਾਂਜੀ ਸਰ ਜੇ ਹੋ ਜੂਗਾ ਤਾਂ ਲੈ ਲਾਂਗੇ ਹਾਂਜੀ ਹਾਂਜੀ ਸਰ ਹਾਂਜੀ ਠੀਕ ਹੈ ਸਰ ਹਾਂਜੀ ਸਰ ਹਾਂਜੀ ਹਾਂਜੀ ਅੱਛਾ ਸਰ ਕੋਈ ਗੱਲ ਨਹੀਂ ਸਰ ਜੋ ਵੀ ਆ ਸਰ ਤੁਸੀਂ ਐਡ ਕਰ ਦਿਓ ਅਤੇ ਮਤਲਬ ਫੋਰਮੈਲਟੀ ਵਗੈਰਾ ਹੈਗੇ ਜੋ ਵੀ ਦੱਸ ਦਿਓ ਠੀਕ ਆ ਸਰ ਠੀਕ ਹੈ ਸਰ ਠੀਕ ਹੈ ਸਰ ਹਾਂਜੀ ਹਾਂਜੀ ਸਰ ਨਹੀਂ ਸਰ ਬਸ ਠੀਕ ਹੈ ਇੰਨਾ ਹੀ ਸੀਗਾ ਕਲੇਮ ਕਰਵਾਉਣਾ ਜੇ ਹੋ ਜੂਗਾ ਹਾਂਜੀ ਸਰ ਧੰਨਵਾਦ ਸਰ ਠੀਕ ਹੈ ਸਰ